ਪਾਣੀ ਦੀ ਸਾਡੇ ਜੀਵਨ ਵਿੱਚ ਬਹੁਤ ਜ਼ਰੂਰਤ ਹੈ ਸਾਨੂੰ ਸਵੇਰੇ ਸਵੇਰੇ ਪਾਣੀ ਪੀਣ ਮੰਜੇ ਤੋਂ ਉੱਠਦੇ ਉੱਠਦਿਆਂ ਪਾਣੀ ਪੀ ਕੇ ਹੀ ਉੱਠਦੇ ਹਾਂ ਉਸ ਤੋਂ ਬਾਅਦ ਅਸੀਂ ਬਾਹਰ ਜਾਂਦੇ ਹਾਂ ਫਲੱਸ਼ 'ਚ ਜਾਂਦੇ ਹਾਂ ਉੱਥੇ ਪਾਣੀ ਦੀ ਜ਼ਰੂਰਤ ਪੈਂਦੀ ਹੈ ਜਦੋਂ ਆਪਾਂ ਨਹਾਉਂਦੇ ਹਾਂ ਉਸ ਟਾਈਮ ਪਾਣੀ ਦੀ ਜ਼ਰੂਰਤ ਪੈਂਦੀ ਹੈ ਰੋਟੀ ਖਾਣ ਦੇ ਟਾਈਮ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਜਦੋਂ ਆਪਾਂ ਘਰ ਕੋਈ ਆ ਜਾਵੇ ਉਸਨੂੰ ਪਲਾਣ ਵਾਸਤੇ ਵੀ ਪਾਣੀ ਦੀ ਜ਼ਰੂਰਤ ਪੈਂਦੀ ਆਉਂਦੇ ਹੀ ਰਿਸ਼ਤੇਦਾਰ ਨੂੰ ਚਾਹ ਤਾਂ ਕੋਈ ਪਲਾਂਦਾ ਨਹੀਂ ਪਹਿਲਾਂ ਪਾਣੀ ਹੀ ਪਲਾਂਦੇ ਹੈ ਜਿਸ ਕਰਕੇ ਪਾਣੀ ਦੀ ਬਹੁਤ ਜ਼ਰੂਰਤ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਕਿ ਅਸੀਂ ਬਾਥਰੂਮ ਜਾਂਦੇ ਹੈ ਉਸ ਟਾਈਮ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਪਿਆਸ ਲੱਗਦੀ ਹੈ ਉਸ ਟਾਈਮ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਦੋਂ ਆਪਾਂ ਬਾਹਰ ਜਾਈਏ ਉਸ ਟਾਈਮ ਵੀ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਾਣੀ ਦੀ ਜ਼ਰੂਰਤ ਹਰ ਟਾਈਮ ਹੀ ਹੁੰਦੀ ਹੈ ਪਾਣੀ ਤੋਂ ਬਿਨਾਂ ਬੰਦਾ ਕੁਝ ਨਹੀਂ ਕਰ ਸਕਦਾ